ਜੀ ਹਾਂ ਮੈਂ ਵੀ ਪੀ ਐੱਨ ਦੀ ਵਰਤੋਂ ਕੀਤੀ ਹੋਈ ਹੈ ਇਸ ਦਾ ਪੂਰਾ ਨਾਮ ਵਰਚੁਅਲ ਪ੍ਰਾਈਵੇਟ ਨੈਟਵਰਕ ਹੈ ਇਹ ਇੱਕ ਸਧਾਰਨ ਸੋਫਟਵੇਅਰ ਹੈ ਜੋ ਤੁਹਾਡੀ ਔਨਲਾਈਨ ਗੋਪਨੀਅਤਾ ਦੀ ਰੱਖਿਆ ਕਰਦਾ ਹੈ ਅਤੇ ਤੁਹਾਡੇ ਟ੍ਰੈਫਿਕ ਅਤੇ ਸਥਾਨ ਨੂੰ ਗੁਪਤ ਰੱਖ ਕੇ ਹੈਕਰਾਂ ਲਈ ਜੀਵਨ ਨੂੰ ਔਖਣਾ ਔਖਾ ਬਣਾਉਣ ਲਈ ਬਣਾਇਆ ਗਿਆ ਸੀ ਪਰ ਤੁਸੀਂ ਇਸ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਤੇਜ਼ ਅਤੇ ਸੁਰੱਖਿਅਤ ਬਰਾਊਜਿੰਗ ਅਤੇ ਹੋਰ ਕਈ ਚੀਜ਼ਾਂ ਲਈ ਵਰਤ ਸਕਦੇ ਹੋ ਮੇਰਾ ਇਸ ਨਾਲ ਅਨੁਭਵ ਇਸ ਤਰੀਕੇ ਨਾਲ ਹੈ ਲੋਕਾਂ ਸੋਫਟਵੇਅਰ ਅਤੇ ਵੈੱਬ ਬਰਾਊਜ਼ਰਾਂ ਨੂੰ ਤੁਹਾਡੇ ਕਨੈਕਸ਼ਨ ਤੱਕ ਪਹੁੰਚ ਪ੍ਰਾਪਤ ਕਰਨ ਤੋਂ ਰੋਕ ਸਕਦਾ ਹੈ ਇਹ ਵੀ ਪੀ ਐੱਨ ਇਹ ਤੁਹਾਡੇ ਦੁਆਰਾ ਸੰਚਾਰਿਤ ਅਤੇ ਪ੍ਰਾਪਤ ਕੀਤੀ ਜਾਣਕਾਰੀ ਨੂੰ ਸੁਰੱਖਿਅਤ ਅਤੇ ਅਗਿਆਤ ਰੱਖਦਾ ਹੈ ਅਤੇ ਲੋਕਾਂ ਤੱਕ ਪਹੁੰਚਣ ਤੋਂ ਰੋਕਦਾ ਹੈ ਇਸ ਲਈ ਇਹ ਇੱਕ ਵਧੀਆ ਨੈਟਵਰਕ ਹੈ